ਮੈਂ ਪਹਿਲਾਂ ਬਜ਼ਾਰ ਗਈ ਬਜ਼ਾਰੋਂ ਰੰਗ ਲਿਆਂਦੇ ਦੋ ਤਿੰਨ ਤਰ੍ਹਾਂ ਦੇ ਰੰਗ ਲਿਆਂਦੇ ਕੱਪੜਾ ਲਿਆਂਦਾ ਫਰੇਮ ਲਿਆਂਦਾ ਫਿਰ ਉਹ ਫਰੇਮ ਘਰ ਘਰ ਲਿਆ ਕੇ ਉਹ ਫਰੇਮ ਅ ਕੱਪੜੇ ਨੂੰ ਫਰੇਮ ਵਿੱਚ ਲਗਾਇਆ ਫਰੇਮ 'ਚ ਲਗਾ ਕੇ ਇੱਕ ਬ੍ਰੈ ਨਾਲ ਬ੍ਰੈਸ਼ ਲਿਆਂਦੇ ਬ੍ਰੈਸ਼ ਨਾਲ ਇੱਕ ਰੰਗਾਂ ਵਾਲੀ ਪਲੇਟ ਲਿਆਂਦੀ ਜੋ ਅਲੱਗ ਅਲੱਗ ਕਲਰ ਸੀਗੇ ਉਹ ਗ ਸਾਰੇ ਰੰਗ ਪਲੇਟ ਵਿੱਚ ਅਲੱਗ ਅਲੱਗ ਪਾਏ ਔਰ ਜੋ ਕੱਪੜਾ ਸੀ ਕੱਪੜੇ ਉੱਤੇ ਫੁੱਲ ਇੱਕ ਫੁੱਲ ਬਣਾਇਆ ਫੁੱਲ ਫੁੱਲ ਨੂੰ ਪੇਂਟ ਕੀਤਾ ਅਲੱਗ ਅਲੱਗ ਪੱਤੀਆਂ ਗ੍ਰੀਨ ਕਲਰ ਦੀ ਹਰੇ ਰੰਗ ਦੀਆਂ ਪੱਤੀਆਂ ਬਣਾਈਆਂ ਔਰ ਫੁੱਲ ਬਣਾਇਆ ਫੁ ਫੁ ਅਤੇ ਉਹ ਅ ਚਿੱਤਰਕਾਰੀ ਵਧੀਆ ਬਣੀ ਉਹ ਪੇਂਟਿੰਗ ਕੀਤੀ ਪੇਂਟਿੰਗ ਕੀਤਾ ਹੋਇਆ ਕੱਪੜਾ ਬਹੁਤ ਸੋਹਣਾ ਲੱਗ ਰਿਹਾ ਸੀ ਅਤੇ ਬਹੁਤ ਵਧੀਆ ਇੱਕ ਸੀਨਰੀ ਬਣ ਕੇ ਤਿਆਰ ਹੋ ਗਈ ਅਤੇ ਸਾਰੇ ਕਲਰ ਵਧੀਆ ਕੰਪਨੀ ਦੇ ਕਲਰ ਖਰੀਦੇ ਅਤੇ ਕਲਰਾਂ ਉਹ ਕਲਰਾਂ ਨੂੰ ਉਹ ਸ਼ ਸ਼ੇਡਸ ਦੇਣ ਵਾਸਤੇ ਹੋਰ ਕਲਰ ਬਣਾਏ ਕਲਰ ਲਗਾਏ ਔਰ ਡਨ ਹ ਪੋ ਜੋ ਫਲਾਵਰ ਬਣਾਇਆ ਸੀ ਫਲਾਵਰ ਦੀਆਂ ਪੱਤੀਆਂ ਨੂੰ ਅਲੱਗ ਅਲੱਗ ਸ਼ੇਡਸ ਦਿੱਤੇ